ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸਾਡਾ ਅੱਜ ਕੱਲ੍ਹ ਦਾ ਜੋ ਵਾਤਾਵਰਣ ਹੈ ਮਹੋ ਮੌਸਮ ਹੈ ਕਿਉਂਕਿ ਵੱਖਰੇ ਵੱਖਰੇ ਪ੍ਰਕਾਰ ਦਾ ਹੋ ਗਿਆ ਹੈ ਆਮ ਤੌਰ 'ਤੇ ਸਾਨੂੰ ਇਹ ਹੋ ਜਾਂਦਾ ਹੈ ਕਿ ਅਸੀਂ ਜਲਦੀ ਜਲਦੀ ਏ ਸੀ ਦੇ ਵਿੱਚ ਜਾਈਏ ਔਰ ਉਸ ਤੋਂ ਤੁਰੰਤ ਬਾਅਦ ਅਸੀਂ ਆਮ ਹਵਾ ਦੇ ਵਿੱਚ ਆ ਜਾਂਦੇ ਹਾਂ ਔਰ ਉਸ ਤੋਂ ਬਾਅਦ ਮੌਸਮ ਦੇ ਨਾਲ ਕੁਛ ਕੁ ਬਿਮਾਰੀਆਂ ਜਿਵੇਂ ਕਿ ਜ਼ੁਕਾਮ ਹੈ ਜ਼ੁਕਾਮ ਇੱਕ ਐਸੀ ਚੀਜ਼ ਹੈ ਜੋ ਕਿ ਬੋਡੀ ਨੂੰ ਥੋੜ੍ਹਾ ਹੀ ਗਰਮ ਠੰਡਾ ਹੋਣ ਦੇ ਨਾਲ ਹੋ ਜਾਂਦਾ ਹੈ ਇਸ ਦੇ ਸਭ ਤੋਂ ਪਹਿਲਾਂ ਸਾਨੂੰ ਇਹ ਆ ਕਿ ਸਾਨੂੰ ਜੋ ਅਗਰ ਸਰਦੀ ਦੇ ਵਿੱਚ ਹੈ ਤਾਂ ਸਾਨੂੰ ਸਹੀ ਤਰੀਕੇ ਨਾਲ ਆਪਣੇ ਫੇਸ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਜਦੋਂ ਇਹ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਕੀ ਏ ਇੱਕ ਆਮ ਤੌਰ 'ਤੇ ਤੁਲਸੀ ਅਦਰਕ ਜੋ ਕਿ ਜਿਸ ਦੇ ਵਿੱਚ ਛੋਟੀ ਇਲਾਇਚੀ ਵਗੈਰਾ ਲੌਂਗ ਵਗੈਰਾ ਪਾ ਕੇ ਅਜਵੈਣ ਪਾ ਲਓ ਇਸ ਦਾ ਇੱਕ ਕਾੜ੍ਹਾ ਬਣਾ ਕੇ ਸਾਨੂੰ ਪੀ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਜੋ ਸਰ ਸਾਡੇ ਸਰੀਰ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਇਨਫੈਕਸ਼ਨ ਹੈ ਐਲਰਜੀ ਹੈ ਉਸਨੂੰ ਕੁਛ ਸਮੇਂ ਬਾਅਦ ਇਹ ਦੂਰ ਕਰ ਦਿੰਦਾ ਹੈ ਇਸ ਨੂੰ ਸਾਨੂੰ ਤਕਰੀਬਨ ਲਗਾਤਾਰ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਜ਼ੁਕਾਮ ਹੈ ਉਹ ਹੱਟ ਜਾਏਗਾ